ਸਾਡੀ ਰਸੋਈ ਵਿੱਚ ਬਹੁਤ ਸਾਰੇ ਭਾਂਡੇ ਹਨ ਜਿਹਨਾਂ ਵਿੱਚੋਂ ਮੈਂ ਕੁੱਝ ਕੁ ਭਾਂਡਿਆਂ ਦਾ ਵਰਣਨ ਕਰੂੰਗੀ ਜਿਵੇਂ ਕਿ ਗੈਸ ਚੁੱਲ੍ਹਾ ਅਤੇ ਦੂਜੇ ਨੰਬਰ 'ਤੇ ਕੁੱਕਰ ਆ ਜਾਂਦਾ ਹੈ ਜਿਹਦੇ ਵਿੱਚ ਆਪਾਂ ਦਾਲ ਬਣਾਉਂਦੇ ਹੈ ਤਰੀ ਵਾਲੀ ਸਬਜ਼ੀ ਬਣਾਉਂਦੇ ਹੈ ਅਤੇ ਉਸ ਤੇ ਬਾਅਦ ਕੜਾਹੀ ਆ ਜਾਂਦੀ ਹੈ ਜਿਹਦੇ ਵਿੱਚ ਆਪਾਂ ਕ ਇੱਕ ਵਿੱਚ ਦੇਗ ਵੀ ਬਣਾਉਂਦੇ ਹੈ ਅਤੇ ਇੱਕ ਕੜਾਹੀ 'ਚ ਸੁੱਕੀ ਸਬਜ਼ੀ ਵੀ ਬਣਾਉਂਦੇ ਹੈ ਇੱਕ ਆਪਾਂ ਨੇ ਫਰਾਈਪਿਨ ਰੱਖਿਆ ਵਾ ਜਿਹਦੇ ਵਿੱਚ ਆਪਾਂ ਤੜਕਾ ਲਾਉਂਦੇ ਹੈ ਇੱਕ ਫਰਾਈਵਿਨ ਹੈ ਡੱਬਾ ਹੈ ਜਿਹਦੇ ਵਿੱਚ ਆਪਾਂ ਚਾਹ ਬਣਾਉਂਦੇ ਹੈ ਦੁੱਧ ਦਾ ਭਾਂਡਾ ਵੀ ਰੱਖਿਆ ਹੋਇਆ ਅਲੱਗ ਬਾਕੀ ਇੱਕ ਵੱਡੇ ਗਲਾਸ ਹਨ ਜਿਹ 'ਚ ਆਪਾਂ ਪਾਣੀ ਵੀ ਪੀ ਸਕਦੇ ਹਨ ਲੱਸੀ ਵੀ ਪੀ ਸਕਦੇ ਹਾਂ ਆਪਣੇ ਕੋਲ ਕੱਚ ਦੇ ਗਲਾਸ ਹੈ ਜਿਹ 'ਚ ਆਪਾਂ ਪਾਣੀ ਪੀਂਦੇ ਹਾਂ ਕੌਲਡ ਡਰਿੰਕ ਵੀ ਪੀਂਦੇ ਹਾਂ ਆਪਣੇ ਕੋਲ ਕੱਪ ਵੀ ਹੈਗੇ ਹੈ ਰਸੋਈ ਵਿੱਚ ਜਿਹਦੇ ਵਿੱਚ ਆਪਾਂ ਗੈਸਟਾਂ ਨੂੰ ਚਾਹ ਦਿੰਦੇ ਹਨ ਪਰ ਆਪਾਂ ਤਾਂ ਸਟੀਲ ਦੇ ਗਲਾਸ ਵਿੱਚ ਹੀ ਚਾਹ ਪੀਂਦੇ ਹਾਂ ਅਤੇ ਦੂਜਾ ਇਹ ਹੈ ਵੀ ਥਾਲ ਵੀ ਹਨ ਜਿਹਦੇ ਵਿੱਚ ਆਪਾਂ ਰੋਟੀ ਵਰਤਾਉਂਦੇ ਹੈ ਅਤੇ ਆਪ ਵੀ ਖਾਂਦੇ ਹਾਂ ਚੌਲ ਚੌਲ ਬਣਾਉਣ ਵਾਸਤੇ ਕੜਾਹੀ ਵੀ ਹੈ ਚਮਚੇ ਵੀ ਹੈ ਜਿਹਦੇ ਨਾਲ ਆਪਾਂ ਮਤਲਬ ਕਿ ਫੌਗ ਵੀ ਹੈ ਜਿਹਦੇ ਨਾਲ ਆਪਾਂ ਨਿਊਡਲ ਖਾਂਦੇ ਹੈ ਚਮਚੇ ਵੀ ਹੈ ਜਿਹਦੇ ਨਾਲ ਆਪਾਂ ਦਹੀਂ ਖਾ ਲਿਆ ਸਬਜ਼ੀ ਖਾ ਲਈ ਚੌਲ ਖਾ ਲਏ ਅਤੇ ਕੌਲੀਆਂ ਜਿਹਨਾਂ ਵਿੱਚ ਆਪਾਂ ਦਾਲ ਸਬਜ਼ੀ ਪਾ ਕੇ ਖਾਂਦੇ ਹਾਂ ਕੜਛੀ ਜਿਹਦੇ ਮੇਨ ਕੜਛੀ ਜਿਹਦੇ ਵਿੱਚ ਆਪਾਂ ਦਾਲ ਸਬਜ਼ੀ ਨੂੰ ਬਣਾਉਂਦੇ ਹਾਂ ਕੜਛੀ ਫੇਰਦੇ ਹੈ ਆਪਣੇ ਕੋਲ ਤਵਾ ਵੀ ਹੈ ਰੋਟੀ ਬਣਾਉਣ ਵਾਸਤੇ ਚਿਮਟਾ ਵੀ ਹੈ ਜਿਹਦੇ ਨਾਲ ਆਪਾਂ ਰੋਟੀ ਰਾੜ੍ਹਦੇ ਹਾਂ ਅਤੇ ਚਮਚੇ ਇੱਕ ਦੇ ਜਿਵੇਂ ਕਿ ਮੰਨ ਲਓ ਓਵਨ ਵੀ ਹੈਗਾ ਹੈ ਅਤੇ ਬਸ ਐਕਸਟ੍ਰਾ ਐਸਟ੍ਰਾ ਬਹੁਤ ਚੀਜ਼ਾਂ ਹਨ ਇਹੋ ਜਿਹੀਆਂ